ਕੱਲ ਮੈਂ ਆਪਣੇ ਏਅਰਟੈਲ ਨੰਬਰ ਦਾ ਰਿਚਾਰਜ ਕਰਨ ਲਈ ਏਅਰਟੈਲ ਵੈਬਸਾਈਟ ਤੇ ਗਿਆ ਮੈ ਰਿਚਾਰਜ ਪ੍ਰਕਿਰਿਆ ਨੂੰ ਪੂਰਾ ਕੀਤਾ ਪ੍ਰੰਤੂ ਮੇਰੇ ਤੋਂ ਗਲਤ ਨੰਬਰ ਦਾ ਰਿਚਾਰਜ ਕਰ ਦਿੱਤਾ ਗਿਆ ਫਿਰ ਮੈਂ ਆਪਣੇ ਏਅਰਟੈਲ ਖਾਤੇ ਵਿੱਚ ਦੁਬਾਰਾ ਤੋਂ ਲੋਗਿਨ ਕੀਤਾ ਲੋਗ ਇਨ ਕਰਨ ਤੋਂ ਬਾਅਦ ਮੇਰਾ ਖਾਤਾ ਓਪਨ ਹੋ ਗਿਆ ਮੈਂ ਉਥੇ ਸੇਵਾਵਾਂ ਸੈਕਸ਼ਨ ਵਿੱਚ ਗਿਆ ਤੇ ਲੈਣ ਦੇਣ ਦਾ ਇਤਿਹਾਸ ਚੈੱਕ ਕੀਤਾ ਮੈਂ ਲੈਣ ਦੇਣ ਦਾ ਇਤਿਹਾਸ ਚੈੱਕ ਕੀਤਾ ਇਥੇ ਮੈਨੂੰ ਸਾਰੇ ਹਾਲ ਹੀ ਦੇ ਰਿਚਾਰਜ ਦੀ ਸੂਚੀ ਦਿਖਾਈ ਦਿੱਤੀ ਮੈਂ ਉਸ ਖਾਸ ਰਿਚਾਰਜ ਨੂੰ ਲੱਭਿਆ ਜਿਸ ਨੂੰ ਮੈਂ ਰੱਦ ਕਰਨਾ ਚਾਹੁੰਦਾ ਹਾਂ ਜੋ ਕਿ ਮੇਰਾ ਲਾਸਟ ਰਿਚਾਰਜ ਸੀ ਫਿਰ ਮੈਂ ਹਰੇਕ ਰਿਚਾਰਜ ਦੇ ਨਾਲ ਆਮ ਤੌਰ ਤੇ ਇੱਕ ਵਿਸਥਾਰ ਜਾਂ ਵੇਰਵਾ ਬਣਿਆ ਹੁੰਦਾ ਹੈ ਮੈਂ ਉਸ ਬਟਨ ਤੇ ਕਲਿੱਕ ਕੀਤਾ ਇਸ ਨਾਲ ਰਿਚਾਰਜ ਬਾਰੇ ਹੋਰ ਜਾਣਕਾਰੀ ਵਾਲਾ ਇੱਕ ਪੰਨਾ ਖੁੱਲ ਗਿਆ ਇਥੇ ਮੈਨੂੰ ਰਿਚਾਰਜ ਰੱਦ ਕਰੋ ਜਾਂ ਵਾਪਸ ਲੈਣ ਦੀ ਬੇਨਤੀ ਕਰੋ ਵਰਗਾ ਕੋਈ ਬਟਨ ਨਹੀਂ ਲੱਭਿਆ ਫਿਰ ਮੈਂ ਰੱਦ ਕਿਰਿਆ ਕਰਨ ਦੀ ਪ੍ਰਕਿਰਿਆ ਨੂੰ ਜਾਰੀ ਰੱਖਿਆ ਜੇਕਰ ਮੈਨੂੰ ਰੱਦ ਕਰਨ ਦਾ ਬਟਨ ਮਿਲ ਜਾਂਦਾ ਤਾਂ ਮੈਂ ਉਸ ਤੇ ਕਲਿੱਕ ਕਰਦਾ ਅਤੇ ਇਸ ਪ੍ਰਕਿਰਿਆ ਨੂੰ ਪੂਰਾ ਕਰ ਦਿੰਦਾ ਇਸ ਵਿੱਚ ਮੈਨੂੰ ਕੁਝ ਵਾਧੂ ਜਾਣਕਾਰੀ ਦੇਣੀ ਪੈ ਸਕਦੀ ਜਿਵੇਂ ਕਿ ਰੱਦ ਕਰਨ ਦਾ ਕਾਰਨ ਰੱਦ ਕਰਨ ਦੀ ਬੇਨਤੀ ਸਬਮਿਟ ਕਰਨ ਤੋਂ ਬਾਅਦ ਮੈਨੂੰ ਪੁਸ਼ਟੀ ਕਰ ਕਰਨਾ ਮਿਲਣਾ ਸੀ ਪਰੰਤੂ ਇਹ ਬਟਨ ਮੈਨੂੰ ਨਾ ਮਿਲਿਆ ਇਸ ਕਰਕੇ ਮੈਂ ਇੱਕ ਸਟੈਪ ਹੋਰ ਅੱਗੇ ਵਧਿਆ ਜਿੱਥੇ ਮੈਨੂੰ ਰੱਦ ਕਰਨ ਦਾ ਆਪਸ਼ਨ ਮਿਲਿਆ ਉੱਥੇ ਮੇਰੇ ਤੋਂ ਰੱਦ ਕਰਨ ਦਾ ਕਾਰਨ ਪੁੱਛਿਆ ਗਿਆ ਜਿਸ ਵਿੱਚ ਮੈਂ ਫਿੱਲ ਕੀਤਾ ਕਿ ਮੇਰੇ ਤੋਂ ਗਲਤ ਨੰਬਰ ਤੇ ਰਿਚਾਰਜ ਹੋ ਗਿਆ ਹੈ ਤੇ ਮੈਂ ਇਸ ਰਿਚਾਰਜ ਨੂੰ ਰੱਦ ਕਰਨਾ ਚਾਹੁੰਦਾ ਹਾਂ ਰੱਦ ਕਰਨ ਦੀ ਬੇਨਤੀ ਮੇਰੀ ਸਾਰੀ ਡਿਟੇਲ ਭਰਨ ਤੋਂ ਬਾਅਦ ਸਬਮਿਟ ਕੀਤੀ ਗਈ ਸਬਮਿਟ ਕਰਨ ਤੋਂ ਬਾਅਦ ਮੈਂ ਰੱਦ ਕਰਨ ਦੀ ਕੋਈ ਰਿਚਾਰਜ ਕੀਤੀ ਮੇਤੋਂ ਰਕਮ ਪੁੱਛੀ ਉਹਨਾਂ ਨੇ ਪੁੱਛਿਆ ਤੁਸੀਂ ਕਿਹੜੇ ਪਲੈਨ ਤੇ ਰਿਚਾਰਜ ਕੀਤਾ ਮੈਂ ਉਸ ਪਲੈਨ ਦਾ ਵੇਰਵਾ ਸਾਰਾ ਦਿੱਤਾ ਭੁਗਤਾਨ ਵਿਧੀ ਦੱਸੀ ਉਹਨਾਂ ਨੂੰ ਉਹਨਾਂ ਨੇ ਰਿਫੰਡ ਲਈ ਮੇਰਾ ਅਕਾਊਂਟ ਨੰਬਰ ਜਾਂ ਮੇਰੀ ਯੂ ਪੀ ਆਈ ਡੀ ਮੰਗੀ ਮੈਂ ਆਪਣੀ ਯੂ ਪੀ ਆਈ ਡੀ ਫਿਲ ਕੀਤੀ ਮੈਂ ਉਹ ਗਲਤ ਨੰਬਰ ਵੀ ਫਿੱਲ ਕੀਤਾ ਉਥੇ ਜਿਹੜਾ ਮੇਰੇ ਪਾਸੋਂ ਰਿਚਾਰਜ ਕਰਨ ਸਮੇਂ ਗਲਤੀ ਨਾਲ ਫਿੱਲ ਹੋ ਗਿਆ ਸੀ ਉਸ ਤੋਂ ਉਪਰੰਤ ਮੈਂ ਆਪਣਾ ਸਹੀ ਪਿੰਨ ਐਂਟਰ ਕੀਤਾ ਜਿਸ ਤੋਂ ਬਾਅਦ ਵੈਬਸਾਈਟ ਵੱਲੋਂ ਮੈਨੂੰ ਪੁਸ਼ਟੀ ਕੀਤੀ ਗਈ ਕਿ ਤੁਹਾਡਾ ਰਿਫੰਡ ਤੁਹਾਡਾ ਰੀਫੰਡ ਅਪਰੂਵਡ ਕਰ ਦਿੱਤਾ ਗਿਆ ਹੈ ਚੋਵੀ ਘੰਟੇ ਦੇ ਵਿੱਚ ਵਿੱਚ ਤੁਹਾਡੇ ਖਾਤੇ ਦੇ ਵਿੱਚ ਇਹ ਰਿਫੰਡ ਦੀ ਰਕਮ ਦਾ ਭੁਗਤਾਨ ਕੀਤਾ ਜਾਏਗਾ